ਮੈਂ ਰੋਜ਼ਾਨਾ ਆਪਣੀ ਜ਼ਿੰਦਗੀ 'ਚ ਅਖਬਾਰ ਪੜ੍ਹਦਾ ਹਾਂ ਅਤੇ ਤਕਰੀਬਨ ਮੈਂ ਡੇਲੀ ਜਗ ਬਾਣੀ ਪੰਜਾਬ ਕੇਸਰੀ ਜਾਂ ਚੜ੍ਹਦੀ ਕਲਾ ਇਹ ਪੜ੍ਹਦਾ ਰਹਿੰਦਾ ਹਾਂ ਪਰ ਜਿਹੜਾ ਮੇਰਾ ਡੇਲੀ ਦਾ ਅਖਬਾਰ ਹੈ ਉਹ ਜਗ ਬਾਣੀ ਹੈ ਅਤੇ ਇਹ ਮੈਨੂੰ ਬੜਾ ਪਸੰਦ ਹੈ ਕਿਉਂਕਿ ਇਹ ਮੇਰੀ ਮਾਂ ਬੋਲੀ ਦੇ ਵਿੱਚ ਪੰਜਾਬੀ 'ਚ ਛਪਾਈ ਕੀਤੀ ਹੋਈ ਹੈ ਅਤੇ ਇਸ ਤੋਂ ਮੈਂ ਕਾਫ਼ੀ ਕੁਛ ਸਿੱਖਿਆ ਹੈ ਪਰ ਲਾਸਟ ਪਿਛਲੇ ਸਾ ਪਿਛਲੇ ਸਾਲ ਦੇ ਵਿੱਚ ਮੈਂ ਕਰੋਨਾ ਕਾਲ ਦੇ ਵਿੱਚ ਹੋਰ ਵੀ ਕਾਫ਼ੀ ਅਖਬਾਰ ਪੜ੍ਹਨ ਦੀ ਕੋਸ਼ਿਸ਼ ਕੀਤੀ ਜਿਵੇਂ ਕਿ ਹਿੰਦੁਸਤਾਨ ਟਾਈਮ ਦੀ ਟ੍ਰਿਬਿਊਨ ਅਤੇ ਇਸ ਤੋਂ ਵਿੱਚ ਇਸ ਅਖ਼ਬਾਰਾਂ ਵਿੱਚੋਂ ਮੈਨੂੰ ਦੀ ਟ੍ਰਿਬਿਊਨ ਅਖ਼ਬਾਰ ਬੜਾ ਵਧੀਆ ਲੱਗਿਆ ਕਿਉਂਕਿ ਇਸ ਦੇ ਵਿੱਚ ਮੈਂ ਕਾਫ਼ੀ ਕੁਛ ਸਿੱਖਿਆ ਜਿਵੇਂ ਕਿ ਅੰਗਰੇਜ਼ੀ ਸਿੱਖਣ ਦਾ ਮੌਕਾ ਮਿਲਿਆ ਉਸਦੇ ਵਿੱਚ ਜਿਹੜੇ ਅੱਖਰ ਸੀਗੇ ਉਹ ਬਹੁਤ ਵਧੀਆ ਲਿਖੇ ਹੋਏ ਸੀਗੇ ਅਤੇ ਉਸਦੇ ਵਿੱਚ ਇੱਕ ਮੈਨੂੰ ਹੋਰ ਬਹੁਤ ਵਧੀਆ ਗੱਲ ਲੱਗੀ ਅੰਤਰਰਾਸ਼ਟਰੀ ਜਿਹੜੀ ਅਖਬਾਰਾਂ ਖਬਰਾਂ ਜਿਹੜੀਆਂ ਸੀਗੀਆਂ ਉਸਦੇ ਵਿੱਚ ਛਪੀਆ ਹੋਈਆ ਸੀਗੀਆਂ ਅਤੇ ਜਿਹੜੇ ਮੇਰੇ ਅਲੌਕਲ ਅਖਬਾਰ ਸੀਗਾ ਜਿਵੇਂ ਕਿ ਜਗ ਬਾਣੀ ਅਤੇ ਟ੍ਰਿਬਿਊਨ ਉਸਦੇ ਵਿੱਚ ਮੈਂ ਘਰੇਲੂ ਖਬਰਾਂ ਜਿਵੇਂ ਕਿ ਅ ਪੰਜਾਬ ਵਿੱਚ ਕੀ ਚੱਲ ਰਿਹਾ ਹੈ ਅਤੇ ਹੋਰ ਚੁਟਕਲੇ ਵਗੈਰਾ ਅਤੇ ਹੋਰ ਰਿਸ਼ਤੇ ਵਗੈਰਾ ਕਰਵਾਉਣੇ ਲੜਕੇ ਲੜਕੀ ਦੇ ਜਾਂ ਜ਼ਮੀਨ ਦਾ ਰੇਟ ਕੀ ਚੱਲ ਰਿਹਾ ਕਿਹੜੇ ਇਲਾਕੇ ਦੇ ਵਿੱਚ ਕਿਵੇਂ ਦਾ ਕਿੰਨੇ ਦਾ ਰੇਟ ਚੱਲ ਰਿਹਾ ਹੈ ਅਤੇ ਜਿਹੜੀ ਅੰਤਰਰਾਸ਼ਟਰੀ ਖਬਰਾਂ ਦੀ ਟ੍ਰਿਬਿਊਨ ਦੇ ਵਿੱਚ ਤਕਰੀਬਨ ਮੈਂ ਪਜ਼ਲਜ਼ ਗੇਮਸ ਅਤੇ ਹੋਰ ਵੀ ਕਾਫ਼ੀ ਕੁਛ ਸਿੱਖਦਾ ਰਿਹਾ ਪਰ ਇਸ ਦੇ ਵਿੱਚ ਮੈਂ ਆਪਣੀ ਇੱਕ ਗੱਲ ਹੋਰ ਵਧੀਆ ਲੱਗੀ ਕਿ ਮੈਂ ਆਪਣੀ ਅੰ ਅੰਗਰੇਜ਼ੀ ਨੂੰ ਬਹੁਤ ਜ਼ਿਆਦਾ ਵਧੀਆ ਅੱਗੇ ਤੱਕ ਲੈ ਕੇ ਗਿਆ ਅਤੇ ਮੈਂ ਆਪਣੀ ਲੈਂਗਵੇਜ਼ ਨੂੰ ਕਾਫ਼ੀ ਸਿੱਖਿਆ ਅੰਗਰੇਜ਼ੀ ਨੂੰ